ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰਾ ਨਾਮ ਗੁਰਜੋਤ ਸਿੰਘ ਹੈ ਜੀ ਮੈਂ ਫੂਡ ਬਲੋਗਰ ਬੋਲ ਰਿਹਾ ਟੇਸਟੀ ਡੈਸ ਮੇਰਾ ਯੂਟਿਊਬ 'ਤੇ ਚੈਨਲ ਹੈ ਜੀ ਅਤੇ ਹਾਂਜੀ ਅਤੇ ਮੈਂ ਸਰ ਇਹ ਪੁੱਛਣਾ ਚਾਹੂੰਗਾ ਆਪਣੇ ਇੱਥੇ ਮਸ਼ਹੂਰ ਅਤੇ ਫੇ ਫੇਮਸ ਡਿਸ਼ ਕਿਹੜੀ ਕਿਹੜੀਆਂ ਤੁਹਾਡੇ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਅੱਛਾ ਜੀ ਅਤੇ ਨੋਨ ਵੈੱਜ ਵਿੱਚ ਕਿਆ ਆ ਜਾਂਦਾ ਜੀ ਆਪਣਾ ਕੋਈ ਹਾਂਜੀ ਠੀਕ ਹੈ ਅਤੇ ਆਪਣੀ ਸਰ ਆਹ ਲੋਕੇਸ਼ਨ ਕਿੱਥੇ ਜੀ ਆਪਣੀ ਜੇ ਆਪਾਂ ਵਿਜ਼ਿਟ ਕਰਨਾ ਹੋਵੇ

ਅੱਛਾ ਜੀ ਮਤਲਬ ਅੱਛਾ ਠੀਕ ਹੈ ਜੀ ਮਤਲਬ ਤੁਹਾਡੇ ਮੇਨ ਰੋਡ ਦੇ ਉੱਪਰ ਆ ਜਾਂਦੀ ਆ ਬਸ ਆਹ ਵਿਦ ਇੰਨ ਇੱਕ ਮੰਥ ਦੇ ਅੰਦਰ ਅੰਦਰ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ ਠੀਕ ਠੀਕ ਓਕੇ ਥੈਂਕ ਯੂ